ਦੋ ਲੱਖ ਸੱਤਰ ਹਜ਼ਾਰ ਪੰਜ ਸੋ ਪੰਨਤਾਲੀ ਇੱਕ ਲੱਖ ਪੰਜਾਹ ਹਜ਼ਾਰ ਪੰਚੱਤਰ ਹਜ਼ਾਰ ਇੱਕ ਲੱਖ ਵੀਹ ਹਜ਼ਾਰ ਇੱਕ ਲੱਖ ਗਿਆਰ੍ਹਾਂ ਹਜ਼ਾਰ